ਜਿਵੇਂ ਕਿ ਤੁਸੀਂ ਮੈਨੂੰ ਪੁੱਛਿਆ ਹੈ ਪੰਜ ਗਵਾਂਢੀਆਂ ਦੇ ਨਾਮ ਸੁਖਜੀਤ ਸਿੰਘ ਕੇਵਲ ਸਿੰਘ ਹਰਪ੍ਰੀਤ ਸਿੰਘ ਅਰਸ਼ਦੀਪ ਸਿੰਘ ਗੀਤਾ ਕੌਰ